ਹੈਲੋ ਹਾਂਜੀ ਟੂਰਿਸਟ ਗਾਇਡ ਬੋਲਦੇ ਹਾਂ ਜੀ ਹਾਂਜੀ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਅਸੀਂ ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਮੈਂ ਟੂਰਿਸਟ ਗਾਈਡ ਇਸੇ ਕਰਕੇ ਹਾਂ ਤੁਸੀਂ ਜਦੋਂ ਵੀ ਜਨਵਰੀ ਆਉਂਗੇ ਮੈਂ ਤੁਹਾਡੀ ਬਹੁਤ ਹੈਲਪ ਕਰੂੰਗੀ ਹਾਂਜੀ ਜ਼ਰੂਰ ਵੀ ਇੱਥੇ ਮਾਘੀ ਦਾ ਮੇਲਾ ਮਾਘੀ ਮਹੀਨੇ ਦੀ ਖੁਸ਼ੀ ਵਿੱਚ ਲੱਗਦਾ ਹੁੰਦਾ ਇੱਥੇ ਮਤਲਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਵੀ ਬਹੁਤ ਹੈ ਅਤੇ ਲੋਹੜੀ ਵੇਲੇ ਇਹ ਮੇਲਾ ਸ਼ੁਰੂ ਹੋ ਜਾਂਦਾ ਵੀ ਮਾਘੀ ਦਾ ਮੇਲਾ ਇੱਥੇ ਦੋ ਜਗ੍ਹਾ ਦੋ ਤਿੰਨ ਜਗ੍ਹਾਵਾਂ 'ਤੇ ਲੱਗਦਾ ਹੁੰਦਾ ਇੱਕ ਤਾਂ ਲੱਗਦਾ ਮੇਨ ਬਾਜ਼ਾਰ ਵੱਲ ਬਠਿੰਡਾ ਰੋਡ ਵੱਲ ਮਲੋਟ ਰੋਡ ਇੱਕ ਬਠਿੰਡਾ ਰੋਡ ਇੱਧਰਲੀ ਸਾਈਡ ਲੱਗਦਾ ਇਹ ਹੁੰਦਾ ਵੱਡੇ ਪੀਰਾਂ ਵਾਲਾ ਮੇਲਾ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਦੁਕਾਨਾਂ ਲੱਗਦੀਆਂ ਹਰ ਤਰ੍ਹਾਂ ਦੀ ਦੁਕਾਨ ਹੁੰਦੀ ਹੈ ਇੱਥੇ ਇੱਥੇ ਘੋੜੀਆਂ ਪੰਛੀਆਂ ਦੀ ਵੀ ਦੁਕਾਨ ਹੁੰਦੀ ਹੈ ਛੋਟੇ ਛੋਟੇ ਕੁੱਤਿਆਂ ਦੀ ਦੁਕਾਨ ਪੰਛੀਆਂ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਇੱਥੇ ਅਤੇ ਹੋਰ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਜਿਊਲਰੀ ਖਰੀਦਣਾ ਚਾਹੁੰਦੇ ਹੋ ਉਹ ਵਾਲੀਆਂ ਦੁਕਾਨਾਂ ਹੋ ਗਈਆਂ ਜਾਂ ਕੁਝ ਵੀ ਲੱਕੜ ਦਾ ਸਮਾਨ ਪਲਾਸਟਿਕ ਦਾ ਸਮਾਨ ਅਤੇ ਇੱਥੇ ਵੱਡੇ ਵੱਡੇ ਝੂਲੇ ਲੱਗਦੇ ਆ ਇਸ ਤੋਂ ਇਲਾਵਾ ਇੱਕ ਲੱਗਦਾ ਮੇਲਾ ਜਲਾਲਾਬਾਦ ਰੋਡ ਵਾਲੀ ਸਾਈਡ ਇੱਥੇ ਕਿਉਂਕਿ ਚਾਰ ਪੰਜ ਇਕੱਠੇ ਹੀ ਗੁਰਦੁਆਰੇ ਇਤਿਹਾਸਿਕ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਉੱਥੇ ਇਹਨਾਂ ਸਾਰੇ ਗੁਰਦੁਆਰਿਆਂ ਵਿੱਚ ਲੱਗਦਾ ਕਿਉਂਕਿ ਇੱਥੇ ਘੋੜ ਦੌੜ ਵੀ ਹੁੰਦੀ ਹੈ ਇੱਥੇ ਨਗਰ ਕੀਰਤਨ ਇੱਥੋਂ ਹੀ ਕੱਢਿਆ ਜਾਂਦਾ ਜਿਹੜਾ ਮਾਘੀ ਦੇ ਮੇਲੇ ਵੇਲੇ ਨਿਕਲਦਾ ਬਹੁਤ ਵੱਡੇ ਪੱਧਰ 'ਤੇ ਨਗਰ ਕੀਰਤਨ ਨਿਕਲਦਾ ਘੋੜਿਆਂ ਨੂੰ ਸਜਾ ਕੇ ਅਤੇ ਪੰਦਰ੍ਹਾਂ ਤਰੀਕ ਨੂੰ ਇਹ ਨਗਰ ਕੀਰਤਨ ਨਿਕਲਦਾ ਹੁੰਦਾ ਸਭ ਤੋਂ ਪਹਿਲਾਂ ਵੱਡੇ ਗੁਰਦੁਆਰੇ ਮੱਥਾ ਟੇਕਦੇ ਆ ਫਿਰ ਸਾਰੇ ਗੁਰਦੁਆਰਿਆਂ 'ਚ ਮੱਥਾ ਟੇਕ ਕੇ ਸ਼ਾਮ ਨੂੰ ਘੋੜ ਦੌੜ ਸ਼ੁਰੂ ਕਰਦੇ ਆ ਅਤੇ ਦੂਰੋਂ ਦੂਰੋਂ ਲੋਕ ਇਹਨੂੰ ਵੇਖਣ ਆਉਂਦੇ ਆ ਇੱਕ ਮੇਲਾ ਲੱਗਦਾ ਘੋੜਿਆਂ ਵਾਲੀ ਮੰਡੀ 'ਚ ਉੱਥੇ ਉਹ ਸਿਰਫ ਮੇਨਲੀ ਆਪਾਂ ਕਹੀਏ ਬੰਦਿਆਂ ਦਾ ਹੀ ਮੇਲਾ ਹੁੰਦਾ ਅਤੇ ਉੱਥੇ ਵੀ ਜਾਨਵਰ ਹੁੰਦੇ ਆ ਅਲੱਗ ਅਲੱਗ ਤਰ੍ਹਾਂ ਦੇ ਜਾਨਵਰ ਲੋਕ ਅਲੱਗ ਅਲੱਗ ਜਗ੍ਹਾਵਾਂ ਤੋਂ ਆਉਂਦੇ ਆ ਅਤੇ ਉੱਥੇ ਆਪਾਂ ਕੋਈ ਵੀ ਤਰ੍ਹਾਂ ਦਾ ਜਾਨਵਰ ਖਰੀਦ ਸਕਦੇ ਜੇ ਤੁਹਾਨੂੰ ਜਾਨਵਰ ਪਸੰਦ ਤਾਂ ਕੋਈ ਵੀ ਨਸਲ ਦਾ ਕੁੱਤਾ ਹੋ ਗਿਆ ਜਾਂ ਘੋੜਾ ਹੋ ਗਿਆ ਜਾਂ ਕੋਈ ਵੀ ਖਰੀਦ ਸਕਦੇ ਹਾਂ ਆਪਾਂ ਉੱਥੇ ਹਾਂਜੀ ਹਾਂਜੀ ਇੱਥੇ ਕਿਉਂਕਿ ਇੱਥੋਂ ਦਾ ਮਾਘੀ ਦਾ ਇਸ਼ਨਾਨ ਹੈ ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ ਚੌਦ੍ਹਾਂ ਤਰੀਕ ਨੂੰ ਮਾਘੀ ਹੁੰਦੀ ਹੈ ਅਤੇ ਦੂਰੋਂ ਦੂਰੋਂ ਲੋਕ ਨਾ ਬਾਰ੍ਹਾਂ ਵਜੇ ਟਰਾਲੀਆਂ 'ਤੇ ਚੜ੍ਹਨਾ ਸ਼ੁਰੂ ਕਰ ਦਿੰਦਾ ਤਾਂ ਕਿ ਉਹ ਇਸ਼ਨਾਨ ਕਰ ਦੇਣ ਉੱਥੇ ਵੀ ਦਿਨ ਤੋਂ ਪਹਿਲਾਂ ਪਹਿਲਾਂ ਇੱਥੋਂ ਦੀ ਖਾਸੀਅਤ ਇਹ ਹੈ ਹਾਂਜੀ ਜ਼ਰੂਰ ਜਦੋਂ ਵੀ ਤੁਸੀਂ ਆਏ ਤੁਸੀਂ ਮੈਨੂੰ ਕਾਲ ਕਰ ਦਿਉ ਅਤੇ ਆਪਾਂ ਥੋੜ੍ਹਾ ਜਿਹਾ ਜਿਹੜਾ ਮੇਰਾ ਪ੍ਰੋਸੀਜਰ ਹੈਗਾ ਆਪਾਂ ਉਹ ਕੰਪਲੀਟ ਕਰ ਲੈਂਦੇ ਹਾਂ ਅਤੇ ਤੁਸੀਂ ਮੈਨੂੰ ਕਾਲ ਕਰ ਦਿਉ ਜਦੋਂ ਵੀ ਆਏ ਅਤੇ ਮੈਂ ਤੁਹਾਨੂੰ ਗਾਈਡ ਕਰ ਦੂੰਗੀ ਓਕੇ